ਹੈਲੋ ਹਾਂਜੀ ਸਟੇਸ਼ਨ ਮਾਸਟਰ ਗੁਰਪ੍ਰੀਤ ਸਿੰਘ ਬੋਲ ਰਹੇ ਜੀ ਹਾਂਜੀ ਐ ਹਾਂਜੀ ਐਕਚੁਲੀ ਨਾ ਮੈਂ ਇੱਧਰ ਪੰਜਾਬ 'ਚ ਨਵਾਂ ਆਇਆ ਸੀਗਾ ਅਤੇ ਮੈਂ ਇੱਥੋਂ ਪਤਾ ਕਰਨਾ ਸੀ ਹੁਣ ਅਸੀਂ ਪਟਿਆਲੇ 'ਚ ਰਿਹਾਇਸ਼ ਲਈ ਹੈ ਅਤੇ ਮੈਂ ਪਤਾ ਕਰਨਾ ਸੀ ਕਿ ਪਟਿਆਲੇ ਤੋਂ ਇੱਥੇ ਕਿਹੜੀ ਕਿਹੜੀ ਮੇਜਰ ਸਿਟੀਜ਼ ਕਨੈੱਕਟ ਹੁੰਦੀਆਂ ਨੇ ਟ੍ਰੇਨ ਰਾਹੀਂ ਅੱਛਾ ਜੀ ਜੇ ਮਤਲਬ ਮੈਂ ਆਪਣੇ ਪਰਿਵਾਰ ਨੂੰ ਲੈ ਕੇ ਇੱਧਰ ਅੰਮ੍ਰਿਤਸਰ ਸਾਹਿਬ ਜਾਣਾ ਹੋਵੇ ਗੋਲਡਨ ਟੈਂਪਲ ਘੁੰਮਣਾ ਹੋਵੇ ਤਾਂ ਉੱਥੋਂ ਸਾਨੂੰ ਟ੍ਰੇਨ ਮਿਲ ਜੇਗੀ ਅੱਛਾ ਜੀ ਸਾਨੂੰ ਸਿੱਧੀ ਟ੍ਰੇਨ ਮਿਲ ਜੇਗੀ ਮਤਲਬ ਸਾਨੂੰ ਵਿੱਚੋਂ ਕੋਈ ਸਟੇਸ਼ਨ 'ਤੇ ਟ੍ਰੇਨ ਬਦਲਣ ਦੀ ਤਾਂ ਨਹੀਂ ਲੋੜ ਪਏਗੀ ਅੱਛਾ ਜੀ ਅਤੇ ਕਿੰਨੇ ਵਜੇ ਚੱਲਦੀ ਆ ਅਤੇ ਜੇ ਟਿਕਟਾਂ ਔਨਲਾਈਨ ਬੁੱਕ ਹੋ ਜਾਂਦੀਆਂ ਨੇ ਜੇ ਅਸੀਂ ਕਰਵਾਉਣੀਆਂ ਹੋਣ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਇਸ ਇਨਫੋਰਮੇਸ਼ਨ ਬਾਰੇ